ਸਤਿ ਸ਼੍ਰੀ ਅਕਾਲ ਸਰ ਤੁਸੀਂ ਸੁਵਿਧਾ ਕੇਂਦਰ ਤੋਂ ਬੋਲ ਰਹੇ ਹੋ ਸਰ ਮੈਂ ਥੋੜੇ ਟਾਈਮ ਪਹਿਲਾਂ ਮੇਰੀ ਦਾਦੀ ਜੀ ਦੀ ਡੈੱਥ ਹੋਈ ਸੀ ਜਿਨਾਂ ਦਾ ਮੌਤ ਸਰਟੀਫਿਕੇਟ ਅਸੀਂ ਦਰਜ ਕਰਵਾ ਦਿੱਤਾ ਗਿਆ ਸੀ ਸਰ ਉਹ ਸਰਟੀਫਿਕੇਟ ਹੁਣ ਸਾਡੇ ਘਰੇ ਬਣ ਕੇ ਆ ਗਿਆ ਜੋ ਕਿ ਦੋ ਦਿਨ ਪਹਿਲਾਂ ਹੀ ਆਇਆ ਹੈ ਜਦੋਂ ਅਸੀਂ ਉਸਨੂੰ ਚੈੱਕ ਕੀਤਾ ਤਾਂ ਉਸ ਵਿੱਚ ਦਾਦੀ ਜੀ ਦਾ ਨਾਮ ਗਲਤ ਸੀ ਉਹਨਾਂ ਦਾ ਨਾਮ ਉਹਨਾਂ ਦੇ ਨਾਮ ਪਿੱਛੇ ਕੌਰ ਦੀ ਕੌਰ ਦੀ ਜਗ੍ਹਾ ਸਿੰਘ ਪਾਇਆ ਹੋਇਆ ਸੀ ਜੋ ਕਿ ਇੱਕ ਗਲਤੀ ਹੈ ਸਰ ਕਿਰਪਾ ਕਰਕੇ ਉਸਨੂੰ ਸਹੀ ਕੀਤਾ ਜਾਵੇ ਇਸ ਲਈ ਜੋ ਵੀ ਤੁਹਾਨੂੰ ਅਪਡੇਟ ਚਾਹੀਦੀ ਹੈ ਜੋ ਵੀ ਡਾਕੂਮੈਂਟ ਚਾਹੀਦਾ ਅਸੀਂ ਉਹ ਤੁਹਾਨੂੰ ਸੈਂਡ ਕਰ ਸਕਦੇ ਆ ਜਾਂ ਫਿਰ ਤੁਹਾਡੇ ਕੋਲ ਆ ਕੇ ਤੁਹਾਨੂੰ ਦੇ ਸਕਦੇ ਹਾਂ ਸਰ ਸਾਨੂੰ ਤੁਹਾਡਾ ਟਾਈਮ ਤੇ ਟਾਈਮ ਦੱਸ ਦੋ ਵੀ ਕਿਸ ਤਰਾਂ ਮੈਂ ਕਿਸੇ ਤੁਹਾਨੂੰ ਮਿਲ ਸਕਦੇ ਆਂ ਅਸੀਂ ਉਹ ਸਹੀ ਕਰਵਾਉਣਾ ਹੈ ਕਿਉਂਕਿ ਹੁਣ ਤਾਂ ਤਾਂ ਦੋ ਦਿਨ ਹੀ ਹੋਏ ਨੇ ਸਰਟੀਫਿਕੇਟ ਆਏ ਨੂੰ ਤਾਂ ਜਲਦੀ ਠੀਕ ਹੋ ਜਾਵੇਗਾ ਤੁਸੀਂ ਆਨਲਾਈਨ ਅਪਡੇਟ ਕਰ ਦੋਗੇ ਸਰ ਕਿਰਪਾ ਕਰਕੇ ਬੇਨਤੀ ਹੈ ਕਿ ਇਸ ਨੂੰ ਸੁਧਾਰਿਆ ਜਾਵੇ ਜੋ ਵੀ ਡਾਕੂਮੈਂਟ ਤੁਹਾਨੂੰ ਚਾਹੀਦੇ ਅਸੀਂ ਤੁਹਾਨੂੰ ਸੈਂਡ ਕਰ ਦੇਵਾਂਗੇ ਕਿ ਇਸ ਗਲਤੀ ਨੂੰ ਪਲੀਜ਼ ਠੀਕ ਕੀਤਾ ਜਾਵੇ ਥੈਂਕਯੂ ਸੋ ਮੱਚ ਸਰ